ਹਾਂਜੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਮੈਡਮ ਕਪੂਰਥਲੇ ਕਪੂਰਥਲੇ ਦੇ ਵਿੱਚ ਹੈਗਾ ਜੀ ਇੱਕ ਸ਼ਾਲੀਮਾਰ ਬਾਗ਼ ਬਹੁਤ ਵਧੀਆ ਜਗ੍ਹਾ ਆ ਘੁੰਮਣ ਵਾਸਤੇ ਬੱਚਿਆਂ ਦੇ ਉੱਥੇ ਝੂਲੇ ਵਗੈਰਾ ਵੀ ਸਭ ਕੁਛ ਲੱਗਾ ਹੋਇਆ ਵਾ ਹਾਂਜੀ ਅਤੇ ਖਾਣ ਪੀਣ ਨੂੰ ਵੀ ਉੱਥੇ ਹੈਗਾ ਸਿਸਟਮ ਸਭ ਫਾਸਟ ਫੂਡ ਵਗੈਰਾ ਸਭ ਕੁਛ ਮਿਲਦਾ ਆ ਇੱਥੋਂ ਬਹੁ ਵਧੀਆ ਵਧੀਆ ਖਾਣ ਪੀਣ ਨੂੰ ਦਿੰਦੇ ਆ ਫਰੈਸ਼ ਝੂਲੇ ਵੀ ਬਹੁਤ ਵਧੀਆ ਵਧੀਆ ਲੱਗੇ ਹੋਏ ਐ ਟਿਕਟ ਕੁਛ ਨਹੀਂ ਵੀ ਹੈ ਮੈਮ ਫ੍ਰੀ ਆ ਫ਼ਿਲਹਾਲ ਬਾਕੀ ਲਾ ਵੀ ਸਕਦੇ ਆ ਕਹਿ ਨਹੀ ਸਕਦੇ ਹਲੇ ਹਲੇ ਫ਼ਿਲਹਾਲ ਫ੍ਰੀ ਹੈਗਾ

ਹਾਂਜੀ ਹਾਂਜੀ ਖਲੌਣੇ ਨਹੀਂ ਹੈਗੇ ਮੈਮ ਝੂਲੇ ਵਗੈਰਾ ਮਿਲ ਜਾਣਗੇ

ਹਾਂਜੀ ਹਾਂਜੀ ਹੈਗਾ ਜੀ